ਮੈਨੂੰ ਲੱਗਦਾ ਹੈ ਜਿਵੇਂ ਮੇਰਾ ਆਪਣਾ ਪਰਸਨਲ ਐਕਸਪੀਰੀਐਂਸ ਹੈਗਾ ਆ ਉਹ ਹੱਥੀਂ ਕਾਰਡ ਦਾ ਜ਼ਿਆਦਾ ਵਧੀਆ ਹੁੰਦਾ ਆ ਜਿੱਦਾਂ ਆਪਾਂ ਸਕੂਲਾਂ ਦੇ ਵਿੱਚ ਦੇਖਦੇ ਹਾਂ ਕਈ ਬੱਚੇ ਟੀਚਰਸ ਨੂੰ ਹੱਥੀਂ ਕਾਰਡ ਦਿੰਦੇ ਆ ਅਤੇ ਕਈ ਮਾਰਕੀਟ ਤੋਂ ਬਾਏ ਕਰਕੇ ਕਾਰਡ ਦਿੰਦੇ ਆ ਜੋ ਕਾਰਡ ਮਾਰਕੀਟ ਤੋਂ ਬਾਏ ਕੀਤਾ ਜਾਂਦਾ ਹੈ ਉਹ ਬੰਦੇ ਨੂੰ ਲਗ ਬੰਦੇ ਨੂੰ ਠੀਕ ਹੈ ਕਾਰਡ ਅੱਛਾ ਹੁੰਦਾ ਆ ਬੰਦਾ ਕਹਿੰਦਾ ਕਿ ਚੱਲੋ ਕਾਰਡ ਵਧੀਆ ਹੈ ਦਿੱਤਾ ਬੱਚੇ ਨੇ ਇੰਟਰਸਟ ਦਿਖਾਇਆ ਬੱਟ ਉਹਦੇ ਨਾਲ ਜ਼ਿਆਦਾ ਖੁਸ਼ੀ ਹੁੰਦੀ ਹੈ ਕੇ ਜਦੋਂ ਕੋਈ ਛੋਟੀ ਕਲਾਸ ਦਾ ਬੱਚਾ ਲਾਈਕ ਫਸਟ ਸੈਕਿੰਡ ਥ ਕਲਾਸ ਦਾ ਬੱਚਾ ਜਦੋਂ ਹੱਥੀਂ ਕਾਰਡ ਬਣਾ ਕੇ ਲਿਆਉਂਦਾ ਬੇਸ਼ੱਕ ਉਹ ਇੱਕ ਪੇਜ ਨੂੰ ਕਈ ਵੇਲੇ ਫਾੜ ਕੇ ਉਹਨੂੰ ਬਣਾ ਕੇ ਕਾਡ ਕਾਰਡ ਦੇ ਸ਼ੇਪ ਦੇ ਕੇ ਲਿਆਉਂਦਾ ਹੈ ਉਹਦੇ 'ਚ ਕਈ ਵੇਲੇ ਉਹਦਾ ਸ ਨਾਮ ਸਰ ਦਾ ਨਾਮ ਲਿਖਦਾ ਆ ਟੀਚਰ ਦਾ ਜੋ ਵੀ ਉਹਨੂੰ ਪਸੰਦ ਹੁੰਦਾ ਹੈ ਉਹਦਾ ਨਾਮ ਲਿਖਦਾ ਹੈ ਸਮਟਾਈਮ ਕਈ ਸਪੈਲਿੰਗ ਮਿਸਟੇਕ ਵੀ ਹੋ ਜਾਂਦੀ ਹੈ ਕਾਰਡ ਦੇ ਵਿੱਚ ਬੱਟ ਉਸ ਕਾਰਡ ਦੇ ਵਿੱਚ ਇੰਨੀ ਕੁ ਜ਼ਿਆਦਾ ਭਾਵਨਾ ਉਹ ਬੱਚੇ ਦੀ ਜੁੜੀ ਹੁੰਦੀ ਹੈ ਜੋ ਇੰਨੀ ਕੁ ਖੁਸ਼ੀ ਦਿੰਦੀ ਸਾਨੂੰ ਕਿ ਇਹਨਾਂ ਦੀ ਕੋਈ ਹੱਦ ਨਹੀਂ ਹੁੰਦੀ ਜਿੱਦਾਂ ਬਹੁਤ ਅੱਛਾ ਲੱਗਦਾ ਹੈ ਕਈ ਬੱਚੇ ਉਹਨੂੰ ਕਾਰਡ ਨੂੰ ਡੈਕੋਰੇਟ ਕਰਨ ਵਾਸਤੇ ਉਹਦੇ 'ਚ ਇੱਕ ਟੋਫੀ ਜਾਂ ਕੋਈ ਫਲਾਵਰ ਜਾਂ ਕੁਛ ਲਗਾ ਦਿੰਦੇ ਹੈ ਅਤੇ ਉਹ ਮਤਲਬ ਬੱਚੇ ਦੀ ਭਾਵਨਾਵਾਂ ਨੂੰ ਦੱਸਦਾ ਹੈ ਕਿ ਬਾ ਬੱਚਾ ਕਿੰਨਾ ਅਟੈਚਡ ਹੈਗਾ ਆ ਮੈਨੂੰ ਲੱਗਦਾ ਹੈ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਹਰ ਚੀਜ਼ ਬਾਏ ਕਰਨ ਦੇ ਨਾਲੋਂ ਕੁਛ ਚੀਜ਼ਾਂ ਜਿੱਦਾਂ ਬੱਚੇ ਬਣਾ ਕੇ ਦਿੰਦੇ ਅਗਰ ਆਪਾਂ ਉਹ ਦੇਈਏ ਤਾਂ ਉਹ ਸਾਡੀ ਫੀਲਿੰਗ ਨੂੰ ਦੱਸੇਗਾ ਅਤੇ ਮੈਨੂੰ ਲੱਗਦਾ ਹੈ ਉਹ ਸਭ ਤੋਂ ਵਧੀਆ ਕੰਮ ਹੈਗਾ ਆ ਅਤੇ ਸਾਨੂੰ ਮਾਰਕੀਟ ਤੋਂ ਕੁਛ ਚੀਜ਼ਾਂ ਨਾ ਬਾਏ ਕਰਕੇ ਜਿਹੜੀ ਚੀਜ਼ ਆਪਾਂ ਆਪਣੇ ਹੱਥੀਂ ਬਣਾ ਸਕਦੇ ਸਪੈਸ਼ਲੀ ਕਾਰਡ ਜਾਂ ਕੋਈ ਡੈਕੋਰੇਸ਼ਨ ਦਾ ਕੋਈ ਵੀ ਸਮਾਨ ਅਤੇ ਸਾਨੂੰ ਖੁਦ ਹੀ ਬਣਾ ਕੇ ਦੇਣਾ ਚਾਹੀਦਾ ਆ ਤਾਂ ਕਿ ਅਗਲੇ ਨੂੰ ਵੀ ਸਾਡਾ ਫੀਲ ਪਤਾ ਲੱਗੇ ਕਿ ਸਾਡੀ ਅਟੈਚਮੈਂਟ ਹੈਗੀ ਹੈ ਜੋ ਆਪਾਂ ਪਰਸਨਲੀ ਉਹਦੇ ਵਾਸਤੇ ਸਮਾਂ ਕੱਢ ਕੇ ਆਹ ਚੀਜ਼ ਬਣਾ ਰਹੇ ਹਾਂ ਅਤੇ ਆਹ ਚੀਜ਼ ਦਾ ਜ਼ਿਆਦਾ ਮੁੱਲ ਆ ਮੇਰੇ ਹਿਸਾਬ ਨਾਲ